ਹਾਂਜੀ ਅਸੀਂ ਹਰ ਰੋਜ਼ ਪਿੰਡਾਂ ਦੇ ਵਿੱਚ ਚਾਰ ਪੰਜ ਘਰਾਂ ਦਾ ਹੋਮਵਿਸਟ ਕਰਨ ਜਾਦੇ ਆ ਇਹਨਾਂ ਹੋਵਿਸਟ ਦੇ ਵਿੱਚ ਅਸੀਂ ਗਰਭਵਤੀ ਔਰਤਾਂ ਦੁੱਧ ਪਿਲਾਓ ਮਾਵਾਂ ਛੇ ਮਹੀਨੇ ਤੋਂ ਤਿੰਨ ਸਾਲ ਦੇ ਬੱਚੇ ਅਤੇ ਕਿਸ਼ੋਰੀਆਂ ਇਹਨਾਂ ਦੀ ਸਿਹਤ ਸਮੀਖਿਆ ਦੀ ਜਾਣਕਾਰੀ ਲੈਦੇ ਹਾਂ ਕਿ ਕਿਸੇ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਰੋਗ ਤਾਂ ਨਹੀਂ ਹੈ ਉਹਨਾਂ ਦੇ ਸਰੀਰ ਚ ਖੂਨ ਦੀ ਕਮੀ ਤਾਂ ਨਹੀਂ ਹੈ ਕੀ ਬੱਚਾ ਕਪੋਸ਼ਤ ਪੈਦਾ ਤਾਂ ਨਹੀਂ ਹੋਇਆ ਕਿ ਬੱਚੇ ਦਾ ਭਾਰ ਵੱਧ ਜਾਂ ਘੱਟ ਤਾਂ ਨਹੀਂ ਹੈ ਕੀ ਬੱਚਾ ਬੋਨਾ ਤਾਂ ਨਹੀਂ ਪੈਦਾ ਹੋਇਆ ਜੇਕਰ ਕੋਈ ਇਹੋ ਜਿਹੀ ਸਥਿਤੀ ਹੁੰਦੀ ਹੈ ਤਾਂ ਅਸੀਂ ਉਸਦੀ ਜਾਣਕਾਰੀ ਸਰਕਾਰ ਨੂੰ ਦਿੰਨੇ ਹਾਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਦੇ ਹਾਂ ਕਿ ਉਹ ਆਪਣੀ ਸਿਹਤ ਦਾ ਅਤੇ ਆਲੇ ਦੁਆਲੇ ਦਾ ਖਾਸ ਧਿਆਨ ਰੱਖਣ ਤੇ ਆਪਣੇ ਘਰਾਂ ਦੇ ਵਿੱਚ ਹੀ ਕਿਚਨ ਗਾਰਡਨ ਤਿਆਰ ਕਰਕੇ ਰੇਹ ਸਪਰੇ ਤੋਂ ਰਹਿਤ ਸਬਜ਼ੀਆਂ ਅਤੇ ਫਲ ਅਗਾਉਣ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਭਿਆਨਕ ਬਿਮਾਰੀ ਤੋਂ ਬਚੇ ਰਹਿਣ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੇ ਭੋਜਨ ਦੇ ਵਿੱਚ ਦੁੱਧ ਦਹੀਂ ਮੀਟ ਆਂਡਾ ਆਦਿ ਨੂੰ ਸ਼ਾਮਿਲ ਕਰਨਾ ਕਿਉਂਕਿ ਅਜਿਹਾ ਕਰਨ ਨਾਲ ਉਹਨਾਂ ਦਾ ਉਹਨਾਂ ਦਾ ਸਰੀਰ ਤੰਦਰੁਸਤ ਰਵੇਗਾ ਅਤੇ ਇੱਕ ਤੰਦਰੁਸਤ ਔਰਤ ਹੀ ਵਧੀਆ ਬੱਚੇ ਨੂੰ ਜਨਮ ਦੇ ਸਕਦੀ ਹੈ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਮਹਾਂਵਾਰੀ ਦੇ ਦੌਰਾਨ ਆਪਣੇ ਸਰੀਰ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਤੇ ਕਿਸ਼ੋਰੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੇ ਭੋਜਨ ਦੇ ਵਿੱਚ ਗੁੜ ਛੋਲੇ ਅਤੇ ਆਇਰਨ ਭਰਪੂਰ ਖੁਰਾਕ ਨੂੰ ਸ਼ਾਮਿਲ ਕਰਨ ਤਾਂ ਕਿ ਉਹਨਾਂ ਦੀ ਸਰੀਰ ਦਾ ਵਾਧਾ ਅਤੇ ਵਿਕਾਸ ਸਹੀ ਢੰਗ ਨਾਲ ਹੋ ਸਕੇ ਅਤੇ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਬਿਮਾਰੀ ਨਾ ਲੱਗੇ ਉਹਨਾਂ ਨੂੰ ਸਮੇਂ ਸਮੇਂ ਤੇ ਆਪਣੇ ਸਰੀਰ ਦਾ ਚੈਕਅਪ ਜਰੂਰ ਕਰਾਉਣਾ ਚਾਹੀਦਾ ਹੈ ਗਰਭਵਤੀ ਔਰਤਾਂ ਨੂੰ ਕਿਹਾ ਗਿਆ ਕਿ ਉਹ ਗਰਭ ਦਾ ਪਤਾ ਲੱਗਣ ਤੇ ਪਹਿਲੇ ਦੋ ਮਹੀਨਿਆਂ ਦੇ ਵਿੱਚ ਆਪਣੇ ਟੈਟਨੋਸ ਦੇ ਦੋਵੇਂ ਟੀਕੇ ਕੰਪਲੀਟ ਕਰਨ ਅਤੇ ਆਪਣਾ ਜੱਚਾ ਬੱਚਾ ਕਾਢ ਹੈਲਥ ਸੈਂਟਰ ਤੋਂ ਬਣਾਉਣ ਉਹ ਆਪਣੀ ਡਿਲੀਵਰੀ ਸਰਕਾਰੀ ਹਸਪਤਾਲ ਦੇ ਵਿੱਚ ਕਰਾਉਣ ਨਾ ਕਿ ਘਰਾਂ ਦੇ ਵਿੱਚ ਆਪਣਾ ਸਿਹਤ ਦਾ ਪੂਰਾ ਧਿਆਨ ਰੱਖਣ ਆਪਣੇ ਬੱਚੇ ਦਾ ਅਤੇ ਆਪਣਾ ਭਾਰ ਸਮੇਂ ਸਮੇਂ ਤੇ ਆਂਗਨਵਾੜੀ ਸੈਂਟਰਾਂ ਵਿੱਚ ਜਾ ਕੇ ਤਲਾ ਕੇ ਲਿਆਉਣ ਸਮੇਂ ਤੇ ਆਪਣੇ ਖੂਨ ਦੀ ਜਾਂਚ ਕਰਾਉਣ ਆਇਰਨ ਦੀਆਂ ਗੋਲੀਆਂ ਸਿਹਤ ਸੰਸਥਾ ਵਿੱਚ ਫਰੀ ਮਿਲਦੀਆਂ ਹਨ ਉਹ ਜਰੂਰ ਹਰ ਮਹੀਨੇ ਉਥੋਂ ਆਇਰਨ ਦੀਆਂ ਗੋਲੀਆਂ ਲੈ ਕੇ ਆਉਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣਾ